ਜੇਕਰ ਕਾਲਜਾਂ ਜਾਂ ਯੂਨੀਵਰਸਿਟੀਆਂ ਦੀ ਗੱਲ ਕੀਤੀ ਜਾਵੇ ਤਾਂ ਕੋਲਜਾਂ ਦਾ ਯੂਨੀਵਰਸਿਟੀਆਂ ਵਿੱਚ ਮੁੰਡਿਆਂ ਅਤੇ ਕੁੜੀਆਂ ਨੂੰ ਇੱਕ ਬਰਾਬਰ ਸਮਝਿਆ ਜਾਂਦਾ ਏ ਜਿਹੜੇ ਕੰਮ ਮੁੰਡੇ ਕਰਦੇ ਹਾਂ ਉਹ ਕੰਮ ਕੁੜੀਆਂ ਵੀ ਕਰੀ ਜਾਂਦੀਆਂ ਨੇ ਅੱਜ ਕੱਲ੍ਹ ਮੁੰਡਿਆਂ ਨਾਲੋਂ ਵੈਸੇ ਵੀ ਕੁੜੀਆਂ ਨੂੰ ਜ਼ਿਆਦਾ ਅੱਗੇ ਰੱਖਿਆ ਜਾਂਦਾ ਏ

ਕੋਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਦੀ ਜ਼ਿਆਦਾ ਗਿਣਤੀ ਆ ਕੁੜੀਆਂ ਜ਼ਿਆਦਾ ਨੇ ਕੋਲਜਾਂ ਦੇ ਯੂਨੀਵਰਸਿਟੀਆਂ ਵਿੱਚ ਜੇ ਪੇਂਡੂ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਪੇਂਡੂ ਖੇਤਰ ਵਿੱਚ ਇੰਨੇ ਪੜ੍ਹੇ ਲਿਖੇ ਲੋਕ ਨਹੀਂ ਰਹਿੰਦੇ ਸਨ ਇੰਨੇ ਪੜ੍ਹੇ ਲਿਖੇ ਲੋਕ ਨਹੀਂ ਸੀ ਹੁੰਦੇ ਅਤੇ ਹੁਣ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਟੈਕਨੋਲਜੀ ਦਾ ਜ਼ਮਾਨਾ ਆ ਗਿਆ ਅਤੇ ਹੁਣ ਪੇਂਡੂ ਖੇਤਰਾਂ ਦੇ ਵਿਚ ਅਤੇ ਆਪਣੇ ਪੇਂਡੂ ਅਤੇ ਆਪਣੇ ਪੇਂਡੂ ਖੇਤਰ ਦੇ ਲੋਕਾਂ ਨੂੰ ਹੁਣ ਰਹਿਣ ਸਹਿਣ ਦਾ ਵੀ ਢੰਗ ਬਹੁਤ ਆ ਗਿਆ ਪਹਿਲਾਂ ਨਾਲੋਂ ਤੇ ਪੇਂਡੂ ਖੇਤਰ ਦੇ ਲੋਕ ਵੀ ਸ਼ਹਿਰੀ ਖੇਤਰਾਂ ਦੇ ਲੋਕਾਂ ਵਾਂਗ ਹੀ ਰ ਰਹਿਣ ਲੱਗ ਪਏ ਨੇ ਅੱਜ ਕੱਲ੍ਹ